ਨਮਸਕਾਰ ਜੀ ਮੈਂ ਐਕਚੁਲੀ ਅਤੇ ਨਾ ਮੈਂ ਨਨਕਾਣਾ ਸਾਹਿਬ ਮੱਥਾ ਟੇਕਣ ਜਾਣਾ ਗੁਰਦੁਆਰੇ ਅਤੇ ਮੈਨੂੰ ਦੱਸੋ ਕਿ ਵਾਇਆ ਕਿੱਧਰ ਥਾਨੀ ਪਏਗਾ ਅਤੇ ਕਿਸ ਤਰ੍ਹਾਂ ਜਾਣਾ ਪਏਗਾ ਥੋੜ੍ਹਾ ਮੈਨੂੰ ਗਾਈਡ ਕਰੋਗੇ ਠੀਕ ਹੈ ਜੀ ਥੈਂਕ ਯੂ ਜੀ ਸ਼ੁਕਰੀਆ